ਪੰਜਾਬ ਇੱਕ ਯੋਧਿਆਂ ਦੀ ਸੂਰਵੀਰਾਂ ਦੀ ਅਤੇ ਗੁਰੂਆਂ ਪੀਰਾਂ ਦੀ ਧਰਤੀ ਹੈ ਇਸ ਲਈ ਪੰਜਾਬ ਵਿੱਚ ਬਹੁਤ ਹੀ ਜ਼ਿਆਦਾ ਲੜਾਈਆਂ ਜਾਂ ਯੁੱਧ ਹੋਏ ਜਿਸ ਵਿੱਚੋਂ ਮੇਰੇ ਏਰੀਏ ਦੇ ਵਿੱਚ ਨੇੜੇ ਸ਼੍ਰੀ ਮੁਕਤਸਰ ਸਾਹਿਬ ਪੈਂਦਾ ਹੈ ਅਤੇ ਇੱਥੇ ਖਿਦਰਾਣੇ ਦੀ ਢਾਬ ਵੀ ਇਹਨੂੰ ਕਿਹਾ ਜਾਂਦਾ ਹੈ ਇੱਥੋਂ ਦਾ ਇਤਿਹਾਸ ਇਹ ਹੈ ਕਿ ਚਮਕੌਰ ਸਾਹਿਬ ਦੀ ਲੜਾਈ ਤੋਂ ਬਾਅਦ ਗੁਰੂ ਸਾਹਿਬ ਤੋਂ ਕੁਝ ਗੁਰੂ ਜਿਹੜੇ ਹੈ ਯੋਧੇ ਅਲੱਗ ਹੋ ਗਏ ਸੀ ਅਤੇ ਉਹਨਾਂ ਨੂੰ ਲਿਖ ਕੇ ਦੇ ਦਿੱਤਾ ਗਿਆ ਸੀ ਵੀ ਉਹ ਸਾਡੇ ਤੋਂ ਅਸੀਂ ਉਹਨਾਂ ਤੋਂ ਅਲੱਗ ਹੋ ਰਹੇ ਹਾਂ ਤਾਂ ਜਦੋਂ ਮੁਕਤਸਰ ਦੇ ਵਿੱਚ ਖਿਦਰਾਣੇ ਢਾਬ ਜਾ ਕੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਯੁੱਧ ਹੋਇਆ ਤਾਂ ਉਸ ਦੌਰਾਨ ਉਹਨਾਂ ਨੂੰ ਲੱਗਿਆ ਵੀ ਸਾਨੂੰ ਗੁਰੂ ਸਾਹਿਬ ਕੋਲ ਦੁਬਾਰਾ ਜਾਣਾ ਚਾਹੀਦਾ ਹੈ ਤਾਂ ਉਹ ਉੱਥੋਂ ਆਪਣਾ ਸਾਰਾ ਕੁਝ ਲੈ ਕੇ ਖਦਰਾਣੇ ਦੀ ਢਾਬ ਵਿੱਚ ਜੰਗ ਵਿੱਚ ਨਾਲ ਗੁਰੂ ਸਾਹਿਬ ਤੋਂ ਮਾਫੀ ਮੰਗ ਕੇ ਯੁੱਧ ਵਿੱਚ ਸ਼ਾਮਿਲ ਹੋ ਗਏ ਅਤੇ ਯੁੱਧ ਵਿੱਚ ਸ਼ਾਮਿਲ ਸ਼ਾਮਿਲ ਹੁੰਦੇ ਜਦੋਂ ਸੱਟਾਂ ਵਗੈਰਾ ਜਾਂ ਜ਼ਖਮੀ ਹੋਏ ਤਾਂ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਵੀ ਸਾਡਾ ਜਿਹੜਾ ਅਸੀਂ ਤੁਹਾਨੂੰ ਲਿਖ ਕੇ ਦਿੱਤਾ ਸੀ ਵੀ ਅਸੀਂ ਤੁਹਾਡੇ ਤੋਂ ਅੱਡ ਹੋ ਰਹੇ ਹਾਂ ਕਿਰਪਾ ਕਰਕੇ ਉਹਨੂੰ ਪਲੀਜ਼ ਪਾੜ ਦਿੱਤਾ ਜਾਵੇ ਤਾਂ ਗੁਰੂ ਸਾਹਿਬ ਨੇ ਉੱਥੇ ਉਹਨੂੰ ਪਾੜ ਦਿੱਤਾ ਗਿਆ ਅਤੇ ਉਸ ਜਗ੍ਹਾ 'ਤੇ ਟੁੱਟੀ ਗੰਢੀ ਸਾਹਿਬ ਦਾ ਜਿਹੜਾ ਗੁਰਦੁਆਰਾ ਹੈ ਸ਼੍ਰੀ ਮੁਕਤਸਰ ਸਾਹਿਬ ਵਿੱਚ ਬਣਿਆ ਗਿਆ ਅਤੇ ਉਹ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਦੀ ਯਾਦਗਾਰ ਵਿੱਚ ਹੀ ਚਾਲ੍ਹੀ ਮੁਕਤਿਆਂ ਦਾ ਇੱਕ ਜਿਹੜਾ ਇਤਿਹਾਸਿਕ ਹੈ ਉਹ ਬਣਿਆ ਹੋਇਆ ਹੈ ਜੋ ਕਿ ਇੱਕ ਨਿਸ਼ਾਨ ਸਾਹਿਬ ਦੇ ਵਿੱਚ ਚਾਲ੍ਹੀ ਕੜੇ ਆਲੇ ਦੁਆਲੇ ਉਹਦੇ ਲੱਗੇ ਹੋਏ ਹੈ ਜੋ ਕਿ ਚਾਲ੍ਹੀ ਮੁਕਤਿਆਂ ਨੂੰ ਦਰਸ਼ਾਉਂਦੇ ਹਨ ਜੋ ਕਿ ਇੱਕ ਡੀਸੀ ਦਫਤਰ ਸ਼੍ਰੀ ਮੁਕਤਸਰ ਸਾਹਿਬ ਦੇ ਨਾਲ ਹੀ ਸਥਿਤ ਹੈ ਉਸ ਨੂੰ ਆਪਾਂ ਨੂੰ ਦੇਖਣਾ ਚਾਹੀਦਾ ਹੈ ਜੋ ਕਿ ਆਪਾਂ ਨੂੰ ਸੂਰਬੀਰਾਂ ਦਾ ਯਾਦ ਕਰਵਾਉਂਦਾ ਹੈ ਸੋ ਇਸ ਲਈ ਮੇਰੇ ਏਰੀਏ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਹੈ ਕਹਾਣੀ ਇਤਿਹਾਸਿਕ ਘਟਨਾਵਾਂ ਆਹੀ ਹੈ ਬਾਕੀ ਹੋਰ ਵੀ ਕੁਝ ਨੇ ਜਿਵੇਂ ਜੈਤੋ ਮੋਰਚਾ ਹੋਇਆ ਸੀ ਥਿੜੀ ਸਾਹਿਬ ਆ ਕੇ ਗੁਰੂ ਗੋਬਿੰਦ ਸਾਹਿਬ ਜੀ ਨੇ ਆਪਣੇ ਇੱਕ ਛੋਟੇ ਜਿਹੇ ਬੂਟੇ 'ਤੇ ਮਤਲਬ ਆਪਦਾ ਕੱਪੜੇ ਸੁਕਾਏ ਸੀ ਅਤੇ ਗੁਰੂਆਂ ਦੇ ਨਾਲ ਦਿਆਂ ਨੇ ਕਿਹਾ ਕਿ ਗੁਰੂ ਜੀ ਇਹ ਤਾਂ ਡਿੱਗ ਜਾਵੇਗਾ ਉਹਨਾਂ ਨੇ ਕਿਹਾ ਇਹ ਸਾਰੀ ਉਮਰ ਨਹੀਂ ਇੱਥੋਂ ਡਿਗ ਸਕ ਡਿੱਗੇਗਾ ਬੂਟਾ ਜਿਹੜਾ ਹੈ ਵੱਡਾ ਹੋ ਜਾਏਗਾ ਅਤੇ ਉਹ ਅੱਜ ਵੀ ਉੱਥੇ ਸਥਿਤ ਹੈ ਜੋ ਕਿ ਆਪਾਂ ਨੂੰ ਇਤਿਹਾਸਿਕ ਜਿਹੜੇ ਆਪਣੇ ਸੂਰਬੀਰਾਂ ਦੀ ਘਟਨਾਵਾਂ ਨੂੰ ਦਰਸਾਉਂਦਾ ਹੈ